ਮੈਨੂੰ ਲਿਖਣ ਦਾ ਬਹੁਤ ਸ਼ੌਕ ਹੈ ਅਤੇ ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਮੈਂ ਲਿਖਣਾ ਜ਼ਰੂਰ ਪਸੰਦ ਕਰਦੀ ਹਾਂ ਜੇਕਰ ਮੈਂ ਅੱਜ ਦੇ ਸਮੇਂ ਵਿੱਚ ਗੱਲ ਕਰਾਂ ਤਾਂ ਅੱਜ ਦੇ ਸਮੇਂ ਦਾ ਜੋ ਮੇਨ ਮੁੱਦਾ ਹੈ ਖਾਸਕਰ ਜੋ ਨੌਜਵਾਨਾਂ ਲਈ ਹੈ ਇਹ ਕਰੀਅਰ ਵਿੱਚ ਚੋਣ ਕਰਨ ਦਾ ਮੁੱਦਾ ਹੈ ਅੱਜ ਕੱਲ੍ਹ ਅ ਨੌਜਵਾਨ ਪੜ੍ਹੇ ਲਿਖੇ ਤਾਂ ਹਨ ਉਹ ਅੱਛੀਆਂ ਅੱਛੀਆਂ ਡਿਗਰੀਆਂ ਵੀ ਹਾਸਿਲ ਕਰ ਲੈਂਦੇ ਹਨ ਪਰ ਕਿਤੇ ਨਾ ਕਿਤੇ ਉਹ ਅੱਗੇ ਆਪਣੇ ਕਰੀਅਰ ਵਿੱਚ ਕਿਹੜਾ ਵਿਕਲਪ ਲੈਣਾ ਹੈ ਕਿਵੇਂ ਦਾ ਹੋਣਾ ਚਾਹੀਦਾ ਹੈ ਇਸ ਵਿੱਚ ਬਹੁਤ ਹੀ ਉਲਝ ਜਾਂਦੇ ਹਨ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਇਨ੍ਹਾਂ ਬਾਰੇ ਲਿਖਾਂ ਅਤੇ ਮੈਂ ਉਨ੍ਹਾਂ ਨੂੰ ਇੱਕ ਸਹੀ ਰਾਹ ਦਿਖਾ ਸਕਾਂ ਕਿ ਉਹ ਕਿਵੇਂ ਅਪਣੇ ਕਰੀਅਰ ਵਿੱਚ ਚੋਣ ਕਰ ਸਕਣ ਅਤੇ ਕਿਹੜੇ ਕਰੀਅਰ ਵਿੱਚ ਕਿਸ ਤਰੀਕੇ ਦੀ ਉਨ੍ਹਾਂ ਨੂੰ ਸਕਿੱਲ ਦੀ ਜ਼ਰੂਰਤ ਹੈ ਅਤੇ ਉਹਨਾਂ ਨੂੰ ਆਪਣੇ ਆਪ ਨੂੰ ਕਿਵੇਂ ਤਿਆਰ ਕਰਨਾ ਹੈ ਕਿਸ ਕੰਮ ਲਈ ਕਿਵੇਂ ਤਿਆਰ ਕਰਨਾ ਜਿਵੇਂ ਅੱਜ ਕੱਲ੍ਹ ਚਕਨੋਲਜੀ ਦਾ ਜ਼ਮਾਨਾ ਹੈ ਅਤੇ ਉਹਨਾਂ ਲੋਕ ਉਨ੍ਹਾਂ ਨੌਜਵਾਨਾਂ ਨੂੰ ਕਿਵੇਂ ਆਪਣੀ ਪੜ੍ਹਾਈ ਆਪਣੀ ਡਿਗਰੀ ਨੂੰ ਕਿਵੇਂ ਚੁਣਨਾ ਚਾਹੀਦਾ ਹੈ ਕਿ ਉਹ ਉਨ੍ਹਾਂ ਦੇ ਅੱਗੇ ਕਰੀਅਰ ਲਈ ਬਹੁਤ ਫਾਇਦੇਮੰਦ ਹੋ ਸਕੇ ਨਾ ਕਿ ਜਿਵੇਂ ਅੱਜ ਕੱਲ੍ਹ ਲੋਕ ਆਪਣੀ ਪੜ੍ਹਾਈ ਨੂੰ ਤਾਂ ਚੁਣ ਲੈਂਦੇ ਹਨ ਕਰ ਲੈਂਦੇ ਹਨ ਪਰ ਅੱਗੇ ਜਾ ਕੇ ਉਹ ਬਹੁਤ ਹੀ ਉਲਝ ਜਾਂਦੇ ਹਨ ਕਿ ਮੈਂ ਆਹ ਪੜ੍ਹਾਈ ਕੀਤੀ ਹੈ ਪਰ ਮੈਂ ਹੁਣ ਮੇਰੇ ਲਈ ਇਹ ਮੇਰੇ ਆਸ ਪਾਸ ਦੀ ਜਗ੍ਹਾ ਵਿੱਚ ਵੀ ਕੋਈ ਇੱਦਾਂ ਦੀ ਕੰਪਨੀ ਨਹੀਂ ਹੈ ਕੋਈ ਇੱਦਾਂ ਦੀ ਜੋਬ ਨਹੀਂ ਹੈ ਅਤੇ ਮੈਂ ਕਈ ਵਾਰ ਉਹਨਾਂ ਦੇ ਘਰ ਦੇ ਦੂਰ ਨਹੀਂ ਜਾਣ ਦਿੰਦੇ ਹਨ ਤਾਂ ਉਹ ਉਹ ਦੂਰ ਜਾ ਕੇ ਵੀ ਜੋਬ ਨਹੀਂ ਕਰ ਪਾਉਂਦੇ ਹਨ ਅਤੇ ਮੈਂ ਚਾਹੁੰਦੀ ਹਾਂ ਕਿ ਉਹਨਾਂ ਨੂੰ ਉਹ ਜੋਬ ਦੇ ਜੋ ਵਿਕਲਪ ਹਨ ਉਹਨਾਂ ਦੇ ਆਪਣੇ ਸ਼ਹਿਰ ਆਪਣੀ ਜਗ੍ਹਾ ਦੇ ਆਸ ਪਾਸ ਵੀ ਮਿਲ ਸਕਣ ਤਾਂਕਿ ਉਹ ਬੇਰੁਜ਼ਗਾਰੀ ਦਾ ਸਾਹਮਣਾ ਵੀ ਨਾ ਕਰ ਸਕਣ